ਘਰ ਵਿੱਚ ਬਗੀਚੀ ਦੀ ਸਾਂਭ ਸੰਭਾਲ ਕਰਨਾ ਕਿੰਨਾ ਕੁ ਸਸਤਾ ਅਤੇ ਮਹਿੰਗਾ ਹੈ ਸਰ ਘਰ ਵਿੱਚ ਜਿਹੜੀ ਆਪਾਂ ਲਗਾਉਂਦੇ ਹਾਂ ਜਿਵੇਂ ਕਿ ਪਾਰਕ ਹੋ ਗਏ ਜਿਵੇਂ ਕਿ ਆਪਾਂ ਉਹਦੇ ਵਿੱਚੇ ਪ ਪਾਲਕ ਮੇਥੇ ਧਨੀਆ ਲਸਣ ਪਿਆਜ਼ ਜੋ ਵੀ ਲਗਾਉਣਾ ਸਰ ਉਹ ਲਗਾ ਲਈਦਾ ਬੀਜ ਬੀਜ ਤੋਂ ਹੀ ਸਰ ਤਿਆਰ ਹੋ ਜਾਂਦਾ ਕਿਉਂਕਿ ਮੈਂ ਸਰ ਮਾਲੀ ਦਾ ਕੰਮ ਕਰਦਾ ਜਾਂ ਉਹਨੂੰ ਆਪਣੇ ਖੇਤਾਂ ਵਿੱਚ ਜਾਂ ਘਰ ਵਿੱਚ ਹੀ ਬੀਜ ਤਿਆਰ ਕਰਕੇ ਸਰ ਉਸਨੂੰ ਲਗਾ ਲਈਦਾ ਜੀ ਅਤੇ ਉਸਦਾ ਬੀਜ ਰੱਖ ਲਈਦਾ ਜੇਕਰ ਆਪਾਂ ਸਰ ਮਾਰਕੀਟ ਦੇ ਵਿੱਚ ਉਹ ਲੈ ਕੇ ਆਵਾਂਗੇ ਸਬਜ਼ੀ ਬਣੀ ਬਣਾਈ ਜਾ ਕੇ ਸਬਜੀ ਹੋਰ ਵੀ ਲੈ ਕੇ ਆਵਾਂਗੇ ਕੋਈ ਵੀ ਚੀਜ਼ ਉਹ ਸਰ ਦੁੱਗਣੇ ਰੇਟ ਤੋਂ ਮਹਿੰਗੀ ਮਿਲਦੀ ਹੈ ਜੇਕਰ ਘਰ ਵਿੱਚ ਇਹ ਆਪਣੇ ਬਾਗ ਵਿੱਚ ਬਗੀਚੀ ਵਿੱਚ ਹੀ ਲਗਾਈ ਹੋਵੇਗੀ ਤਾਂ ਸਰ ਉਹ ਆਪਾਂ ਨੂੰ ਬੈਨੀਫਿਟ ਹੀ ਹੈ ਸਰ ਨਾਲੇ ਸ਼ੁੱਧ ਹੋਵੇਗੀ ਸਰ ਜੀ ਉਹ ਆਪਣੇ ਅੱਖਾਂ ਦੇ ਸਾਹਮਣੇ ਹੋਵੇਗੀ ਜੀ ਉਹ ਤਾਂ ਆਪਣੇ ਅੱਖਾਂ ਦੇ ਸਾਹਮਣੇ ਹੋਵੇਗੀ ਸਰ ਸਾਫ ਪਾਣੀ ਲੱਗੇਗਾ ਉਹਨੂੰ ਸ਼ੁੱਧ ਹੋਊ